ਹੈਲੋ ਹੈਲੋ ਸੱਸਰੀਕਾਲ ਭੈਣ ਜੀ ਕੀ ਹਾਲ ਆ ਬਾਸ ਵਧੀਆ ਤੁਸੀਂ ਸੁਣਾਓ ਜੀ ਬੱਚੇ ਬੁੱਚੇ ਠੀਕ ਆ ਹਾਂਜੀ ਤੁਸੀਂ ਕੀ ਕਰੀ ਜਾਦੇ ਹੋ ਬਾਜ਼ਾਰ ਦੀਦੀ ਸ਼ਨੀ ਐਤਵਾਰ ਆ ਬਾਹਰ ਜਾਣ ਨੂੰ ਜਮਾਂ ਈ ਨੀ ਜੀਅ ਕਰਦਾ ਪਿਆ ਟ੍ਰੈਫਿਕ ਈ ਬਾਹਲਾ ਟ੍ਰੈਫਿਕ ਨੰਘਣ ਟ੍ਰੈਫਿਕ 'ਚ ਨੰਘਿਆ ਨੀ ਜਾਂਦਾ ਬਹੁਤ ਜਿਆਦਾ ਟ੍ਰੈਫਿਕ ਹੁੰਦਾ ਆਪਣੇ ਹਾਂਜੀ ਇਹਨਾਂ ਨੂੰ ਛੋਟੀ ਭੀੜੀਆਂ ਗਲੀਆਂ ਚ ਇਹਨਾਂ ਨੂੰ ਗੱਡੀਆਂ ਨਹੀਂ ਵੜਨਾ ਚਾਹੀਦਾ ਹਨਾ ਖੋ ਜਾਂਦਾ ਮੈਹਦੀ ਆਲੇ ਆਟੋ ਬਾਹਲੇ ਹੋਏ ਪਏ ਆ ਉਹਨਾਂ ਨੇ ਜਿਆਦਾ ਟ੍ਰੈਫਿਕ ਉਹ ਕਰਤਾ ਮੈਂ ਤਾਂ ਆਪ ਡਰਦੀ ਬੱਚਿਆਂ ਨੂੰ ਜਾਣ ਨਹੀਂ ਦਿੰਦੀ ਮੈਂ ਕਹਿੰਦੀ ਟ੍ਰਾਫਿਕ ਬਹੁਤ ਜਿਆਦਾ ਟਾਈਮ ਬਹੁਤ ਲੱਗ ਜਾਂਦਾ ਬਾਜ਼ਾਰ ਜਾਣ ਤੋਂ ਟ੍ਰਾਫਿਕ 'ਚ ਨੰਘਿਆ ਨੀ ਜਾਂਦਾ ਸਭ ਤੋ ਬੰਦਾ ਅੱਜ ਕੱਲ ਬੰਦੇ ਕੋਲ ਟਾਈਮ ਹੁੰਦਾ ਨੀ ਗਾ ਬਜ਼ਾਰ ਜਾਈਦਾ ਤਾਂ ਘੰਟਾ ਘੰਟਾ ਦੋ ਦੋ ਘੰਟੇ ਆਪਾਂ ਟ੍ਰੈਫਇਕ 'ਚ ਹੀ ਫਸੇ ਰਹਿੰਦੇ ਆ

ਹੋਰ ਇਹਨਾਂ ਨੇ ਸਕੂਲ ਜਾਣਾ ਡਿਊਟੀ ਜਾਣਾ ਐਮ ਲੇਟ ਹੋ ਜਾਂਦੇ ਆ ਟ੍ਰੈਫਿਕ ਕਰਕੇ ਫਿਰ ਜਦੋਂ ਛੁੱਟੀ ਸਕੂਲੋਂ ਹੁੰਦੀ ਆ ਉਦੋਂ ਵੀ ਬਹੁਤ ਜਿਆਦਾ ਟ੍ਰੈਫਿਕ ਹੁੰਦਾ ਹਾਂਜੀ ਬਹੁਤ ਜਿਆਦਾ ਟਰੈਫਿਕ ਹੋਣਾ ਫਿਰ ਇਹਨਾਂ ਨੂੰ ਇਨਾ ਟਰਾਫਿਕ ਨਹੀਂ ਕਰਨਾ ਚਾਹੀਦਾ ਛੋਟੀਆਂ ਗਲੀਆਂ 'ਚ ਵੱਡੇ ਵਹੀਕਲ ਨਹੀਂ ਲਿਜਾਣੇ ਚਾਹੀਦੇ ਜਿਵੇਂ ਹੁਣ ਗੱਡੀਆਂ ਹੋਗੀਆ ਆਟੋ ਹੋ ਗਏ ਥਰੀ ਵੀਲਰ ਜੇ ਜਿਹੜੇ ਪਾਈ ਫਿਰਦੇ ਆ ਉਹ ਹੋ ਗਏ ਹਾਂਜੀ ਕਿਉਂਕਿ ਛੋਟੀਆਂ ਗੱਡੀਆਂ ਤਾਂ ਫਿਰ ਹਾਂ ਬਾਕੀ ਟਰੈਫਿਕ ਲਾਈਟਾਂ ਵੀ ਬੰਦੇ ਜੋ ਟਰਾਫਿਕ ਲਾਈਟਾਂ ਚੱਲਦੀਆਂ ਤਾਂ ਵੀ ਖੜਨਾ ਪੈਂਦਾ ਟਰਾਫਿਕ ਜਿਆਦਾ ਹਨਾ ਹੁੰਦਾ ਉਹਦੇ ਕਰਕੇ ਇਦਾਂ ਕਰਕੇ ਵੀ ਖੜਨਾ ਪੈਂਦਾ ਆਪਾਂ ਨੂੰ ਹਾਂ ਆਪਾਂ ਸੈਚਰਡੇ ਸੰਡੇ ਫਿਰ ਭੀੜ ਹੋ ਜਾਂਦੀ ਨਾ ਬਜਾਰ ਚ ਟਰਾਫਿਕ ਬਹੁਤ ਹੁੰਦਾ ਹਾਂਜੀ ਨਾਲੇ ਟਾਈਮ ਬਹੁਤ ਲੱਗਦਾ ਫਿਰ ਟ੍ਰੈਫਿਕ ਕਰਕੇ ਇਹਦੇ ਕਰਕੇ ਫਿਰ ਠੀਕ ਆ ਫਿਰ ਆਪਾਂ ਮੰਡੇ ਮੁੰਡੇ ਨੂੰ ਦੇਖਦੇ ਆਂ ਠੀਕ ਆ ਮੈਮ ਓਕੇ ਸੱਸਰੀਕਾਲ